ਜਿੱਦਾਂ ਆਪਾਂ ਦੇਖਦੇ ਹੈਗੇ ਹੈ ਕਿ ਬੱਚੇ ਬਹੁਤ ਜ਼ਿਆਦਾ ਸਕਰੀਨ ਦੇਖਦੇ ਜਾਂ ਮੋਬਾਈਲ ਚਲਾਉਂਦੇ ਹੈ ਜਾਂ ਉੱਦਾਂ ਫਿਜੀਕਲੀ ਆਪਾਂ ਕੋਈ ਐਕਟੀਵਿਟੀ ਨਹੀਂ ਕਰਦੇ ਹੈਗੇ ਹੈ ਜਾਂ ਗੇਮਾਂ ਨਹੀਂ ਖੇਡਦੇ ਹੈਗੇ ਹੈ ਉਹ ਇਹਦੇ ਕੁਛ ਕੁ ਕਾਰਨ ਹੈਗੇ ਹੈ ਜਿੱਦਾਂ ਹੁਣ ਮਾਤਾ ਪਿਤਾ ਹੈ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਨਹੀਂ ਕਰਦੇ ਹੈਗੇ ਹੈ ਚਲ ਬੱਚੇ ਹੈਗੇ ਹੈ ਆਪਣੇ ਜਿਹੜਾ ਟਾਈਮ ਹੈ ਉਹ ਸਹੀ ਜਗ੍ਹਾ ਯੂਟੀਲਾਈਜ ਨਹੀਂ ਕਰਦੇ ਹੈਗੇ ਉਹਨੂੰ ਅਤੇ ਗਲਤ ਜਗ੍ਹਾ ਆਪਣਾ ਸਾਰਾ ਸਾਰਾ ਟਾਈਮ ਉਹ ਖਰਾਬ ਕਰ ਦਿੰਦੇ ਹੈਗੇ ਹੈ ਜਿੱਦਾਂ ਹੁਣ ਆਪਾਂ ਦੇਖਦੇ ਹੈਗੇ ਹੈ ਵੀ ਚਾਰ ਬੰਦੇ ਕਿਤੇ ਵੀ ਖੜ੍ਹੇ ਹੈਗੇ ਹੈ ਉਹ ਗੱਲਬਾਤ ਨਹੀਂ ਕਰਦੇ ਇੱਕ ਦੂਜੇ ਨਾਲ ਫੋਨਾਂ 'ਚ ਵੜੇ ਰਹਿੰਦੇ ਹੈਗੇ ਹੈ ਉਹ ਤੋਂ ਬਾਅਦ ਜਿਹਦੇ ਨਾਲ ਸਾਡੀਆਂ ਅੱਖਾਂ 'ਤੇ ਕਾਫੀ ਬੁਰੇ ਪ੍ਰਭਾਵ ਪੈਂਦੇ ਹੈਗੇ ਹੈ ਸਾਡੀ ਗਰੋਥ ਰੁਕ ਜਾਂਦੀ ਹੈਗੀ ਹੈ ਫਿਜੀਕਲ ਐਕਟੀਵਿਟੀ ਘੱਟ ਘੱਟ ਜਾਂਦੀ ਹੈਗੀ ਸਾਡੀ ਇਹਦੇ ਨਾਲ ਜਿਹਨੂੰ ਆਪਾਂ ਜਿੱਦਾਂ ਹੁਣ ਇਹਨੂੰ ਕਹਿੰਦੇ ਹੈ ਆਪਾਂ ਇਹਨੂੰ ਪ੍ਰੇਰਿਤ ਕਿੱਦਾਂ ਕਰਨਾ ਚਾਹੀਦਾ ਬੱਚਿਆਂ ਨੂੰ ਤਾਂ ਪ੍ਰੇਰਿਤ ਕਰਨ ਵਾਸਤੇ ਉਨ੍ਹਾਂ ਨੂੰ ਪਹਿਲਾਂ ਤਾਂ ਇੱਕ ਗਰਾਊਂਡ ਹੋਣਾ ਚਾਹੀਦਾ ਹੈਗਾ ਹੈ ਪਿੰਡ 'ਚ ਵਧੀਆ ਅਤੇ ਨੰਬਰ ਦੋ 'ਤੇ ਇੱਕ ਵਧੀਆ ਕੋਚ ਹੋਣਾ ਚਾਹੀਦਾ ਹੈਗਾ ਹੈ ਸਰਕਾਰ ਨੂੰ ਟੂਰਨਾਮੈਂਟ ਕਰਵਾਉਣੇ ਚਾਹੀਦੇ ਹੈਗੇ ਹੈ ਤਾਂ ਜੋ ਬੱਚਿਆਂ ਦੀ ਫਿਜੀਕਲੀ ਮੈਂਟਲੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਕੁਆਲਿਟੀ ਵਗੈਰਾ ਇਹ ਸਾਰਾ ਕੁਛ ਡਿਵੈਲਪ ਹੋਣ ਉਹਦੇ ਨਾਲ